ਪੰਜਾਬ ਵਿੱਚ ਮੁਖ ਪ੍ਰਮੁੱਖ ਖੇਡਾਂ ਕਬੱਡੀ ਹੋਕੀ ਹਨ ਕਈ ਹੋਰ ਵੀ ਖੇਡਾਂ ਹਨ ਬਟ ਕਿ ਕਬੱਡੀ ਨਾਲੇ ਹੋਕੀ ਇਹ ਪੰਜਾਬ ਤੋਂ ਹੀ ਸ਼ੁਰੂ ਹੋਈਆਂ ਨੇ ਅਤੇ ਕਈ ਕਲੱਬ ਨੇ ਇਹਦੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਕਈ ਇੱਦਾਂ ਦੇ ਕਲੱਬ ਨੇ ਕਿ ਜਿੱਥੋਂ ਕਈ ਖਿਡਾਰੀ ਨਿਕਲੇ ਹਨ ਇੰਟਰਨੈਸ਼ਨਲ ਖੇਡਣ ਕਬੱਡੀ ਵੀ ਖੇਡਦੇ ਹਨ ਅਤੇ ਹੋਕੀ ਵੀ ਖੇਡਦੇ ਨੇ ਜੋ ਕਿ ਇੰਡੀਆ ਨੂੰ ਰੀਪ੍ਰਜੈਂਟ ਕਰਦੇ ਹਨ ਖੇਡਣ ਲਈ ਇਹ ਇੱਥੇ ਬਹੁਤ ਜ਼ਿਆਦਾ ਸਥਾਨਕ ਹਨ ਮੇਜ਼ਾ ਮੇਜ਼ਬਾਨੀ ਕਰਦੇ ਹਨ